ਅਸੀਂ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਸਕੂਲਾਂ ਕਾਲਜਾਂ ਵਿੱਚ ਇੱਕ ਇੱਕ ਬੁੱਕਸ ਬੁੱਕ ਜ਼ਰੂਰ ਲਗਾਉਣੀ ਚਾਹੀਦੀ ਹੈ ਕਿ ਆਪਣੀ ਮਾਂ ਬੋਲੀ ਭਾਸ਼ਾ ਬੱਚਿਆਂ ਨੂੰ ਨੂੰ ਪਤਾ ਲੱਗੇ ਇੱਕ ਪੀਰੀਅਡ ਜ਼ਰੂਰ ਲਗਾਉਣਾ ਚਾਹੀਦਾ ਪੀਡ ਪੰਜਾਬੀ ਦਾ ਜੀ ਜੋ ਕਿ ਆਪਣੀ ਮਾਂ ਬੋਲੀ ਹੈ ਅਸੀਂ ਆਪਣੀ ਮਾਂ ਬੋਲੀ ਭਾਸ਼ਾ ਨੂੰ ਬਚਾ ਸਕਦੇ ਹਾਂ